ਬਿਜਲੀ ਦਾ ਸਾਡੇ ਘਰ 'ਚ ਚੌਵੀ ਘੰਟੇ ਆਉਂਦੀ ਆ ਪਰ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਆ ਜ਼ਿਆਦਾਤਰ ਮੌਸਮ ਖ਼ਰਾਬ ਹੋਣ ਕਾਰਨ ਕਰੀਬ ਕਿਤੇ ਕੋਈ ਤਾਰ ਟੁੱਟ ਜਾਂਦੀ ਆ ਕਦੀ ਕਿਤੇ ਕੋਈ ਖੰਭਾ ਡਿੱਗ ਗਿਆ ਜੇ ਇਸ ਕਰਕੇ ਬਿਜਲੀ ਦੀ ਬੜੀ ਪਰੇਸ਼ਾਨੀ ਆਉਂਦੀ ਆ ਬਾਕੀ ਸਾਰਾ ਕੰਮ ਹੀ ਬਿਜਲੀ 'ਤੇ ਹੁੰਦਾ ਆ ਜੇ ਮਨੋਰੰਜਨ ਦਾ ਐ ਵੇ ਅਤੇ ਉਹ ਬਿਜਲੀ ਨਾਲ ਹੀ ਆ ਕੋਈ ਟੀ ਵੀ ਦੇਖ ਲਓ ਕੋਈ ਕੋਈ ਗਾਣਾ ਲਾ ਲਓ ਕੋਈ ਇੱਦਾਂ ਦੇ ਸਾਰੇ ਕੰਮ ਹੀ ਜੀ ਪਾਣੀ ਹੈ ਅਤੇ ਪਾਣੀ ਵੀ ਬਿਜਲੀ ਨਾਲ ਹੀ ਆਉਣਾ ਆ ਸਾਰੇ ਕੰਮ ਹੀ ਬਿਜਲੀ ਦੇ ਆ ਅਤੇ ਬਿਜਲੀ ਦੇ ਕੱਟ ਬਹੁਤ ਜ਼ਿਆਦਾ ਲੱਗਦੇ ਆ ਅਤੇ ਗਰਮੀਆਂ ਵਿੱਚ ਤਾਂ ਉਹ ਹੋਰ ਜ਼ਿਆਦਾ ਲੱਗਦੇ ਆ ਨਾ ਗਰਮੀ ਗਰਮੀ ਵਿੱਚ ਤਾਂ ਵੈਸੇ ਬੱਚੇ ਵੀ ਰੋਂਦੇ ਆ ਬਹੁਤ ਜ਼ਿਆਦਾ ਅਤੇ ਬੱਚਿਆਂ ਲਈ ਵੀ ਬੜੀ ਜ਼ਰੂਰੀ ਹੈ ਬਿਜਲੀ ਏ ਸੀ ਲੱਗ ਜਾਂਦੇ ਆ ਗਰਮੀ 'ਚ ਤਾਂ ਬਿਜਲੀ ਹੋਰ ਘੱਟ ਜਾਂਦੀ ਆ ਬਹੁਤ ਘੱਟ ਬਿਜਲੀ ਆਉਂਦੀ ਆ ਇਸ ਕਰਕੇ ਬਿਜਲੀ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਘਰ 'ਚ